ਹਾਂ ਭੰਗੜੇ ਦੀ ਮਹੱਤਤਾ ਬਾਰੇ ਅਸੀਂ ਦੱਸ ਸਕਦੇ ਹਾਂ ਭੰਗੜਾ ਇੱਕ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਇਸ ਨੂੰ ਅਸੀਂ ਹਰ ਖੁਸ਼ੀ ਵਿਆਹ ਦੇ ਮੌਕੇ 'ਤੇ ਅਸੀਂ ਪਾਉਂਦੇ ਹਾਂ ਭੰਗੜੇ ਨਾਲ ਸਾਡੇ ਅੰਦਰ ਬਹੁਤ ਹੀ ਉਤਸਾਹ ਪੈਦਾ ਹੁੰਦਾ ਹੈ ਇਸ ਨੂੰ ਲੋਕੀ ਬਹੁਤ ਹੀ ਦੂਰ ਦੁਰਾਡੇ ਲੋਕਾਂ ਵਿੱਚ ਰੀਲਾਂ ਬਣਾ ਕੇ ਭੇਜਦੇ ਹਨ ਇੱਕ ਦੂਜੇ ਨੂੰ